ਹੈਲੋ ਸਤਿ ਸ਼੍ਰੀ ਅਕਾਲ ਜੀ ਸਰ ਜੀ ਮੈਂ ਨਾ ਪਾਹੁਲ ਬੋਲ ਰਿਹਾ ਵਾਂ ਹਾਲ ਹੀ ਵਿੱਚ ਨਾ ਕਪੂਰਥਲਾ ਸ਼ਹਿਰ ਚ ਸਿਫਟ ਹੋਇਆ ਵਾ ਮੈਂ ਸੁਣਿਆ ਕਿ ਪੰਜ ਮੰਦਰ ਇੱਥੇ ਇੱਕ ਪ੍ਰਸਿੱਧ ਧਾਰਮਿਕ ਤੇ ਇਤਿਹਾਸਿਕ ਥਾਂ ਹੈ ਤੁਸੀਂ ਇਸ ਬਾਰੇ ਕੁਝ ਦੱਸ ਸਕਦੇ ਹੋ ਮੈਨੂੰ ਮੈਂ ਇਨਾ ਸੋਚ ਰਿਹਾ ਸੀ ਕਿ ਹੁਣ ਮੈਂ ਨਵਾਂ ਨਵਾਂ ਸ਼ਿਫਟ ਹੋਇਆ ਵਾਂ ਮੈਂ ਆਪਣੀ ਫੈਮਲੀ ਲੈ ਕੇ ਜਾਵਾਂ ਮੈਂ ਤੁਹਾਨੂੰ ਮੈਂ ਸੋਚਿਆ ਕਿ ਤੁਹਾਡੇ ਤੋਂ ਸਲਾਹ ਲੈ ਲਈ ਜਾਵੇ ਛੋਟੀ ਜੀ ਅੱਛਾ ਜੀ ਇਹ ਤਾਂ ਕੋਈ ਦਿਲਚਸਪ ਲੱਗਦਾ ਜੀ ਪਰ ਮੈਂ ਸੋਚ ਰਿਹਾ ਸੀ ਕਿ ਇਹਦਾ ਨਾ ਜਿਹੜਾ ਨਾਮ ਹੈਗਾ ਵਾ ਉਹ ਪੰਜ ਮੰਦਰ ਕਿਉਂ ਰੱਖਿਆ ਗਿਆ ਵਾ ਇਹ ਬਹੁਤ ਵਧੀਆ ਜੀ ਬਹੁਤ ਵਧੀਆ ਕੀ ਇੱਥੇ ਕੋਈ ਹੋਰ ਜਿਦਾ ਕੀ ਕੋਈ ਮਤਲਬ ਸਮਾਗਮ ਸਮੁਗਮ ਹੁੰਦੇ ਸੀ ਵਿਸ਼ੇਸ਼ ਸਮਾਗਮ ਹੋਣ ਜਾਂ ਫੈਸਟੀਵਲ ਹੁੰਦੇ ਤੇ ਮਨਾਏ ਜਾਂਦੇ ਆ ਅੱਛਾ ਜੀ ਬਹੁਤ ਵਧੀਆ ਕੀ ਇੱਥੇ ਕੋਈ ਹੋਰ ਵੀ ਗਤੀਵਿਧੀਆ ਕਰ ਸਕਦੇ ਆ ਹਾਂਜੀ ਇਹ ਸੁਣ ਕੇ ਜੀ ਬਹੁਤ ਚੰਗਾ ਲੱਗਿਆ ਸਰ ਜੀ ਇੱਕ ਹੋਰ ਗੱਲ ਪੁੱਛਣੀ ਸੀ ਤੁਹਾਨੂੰ ਕਿ ਨਾ ਮੈਨੂੰ ਨਵਾਂ ਨਵਾਂ ਲੋਕੇਸ਼ਨ ਵੀ ਨਹੀਂ ਪਤਾ ਕਿੱਥੇ ਹੈਗੀ ਆ ਇਹ ਸ਼ਹਿਰ ਦੇ ਅੰਦਰ ਕੀ ਉਹ ਬਾਹਰ ਹੈਗਾ ਕਿੱਥੇ ਹੈਗੀ ਸ਼ਹਿਰ ਚ ਥਾਂ ਬਹੁਤ ਧੰਨਵਾਦ ਅਮਨ ਜੀ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ ਮੈਂ ਜਲਦੀ ਇੱਥੇ ਜਾਣ ਦੀ ਯੋਜਨਾ ਬਣਾਉਦਾ ਵਾਂ ਜੀ ਬਹੁਤ ਜਿਆਦਾ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੰਨਵਾਦ